ਕਈ ਵਾਰ ਜਦੋਂ ਸਾਡੇ ਘਰ ਕਿਸੇ ਆਦਮੀ ਜਾਂ ਬੱਚੇ ਨੂੰ ਸੱਟ ਲੱਗ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਉਸਨੂੰ ਘਰੇਲੂ ਇਲਾਜ ਕਰਨਾ ਚਾਹੀਦਾ ਹੈ ਜਿਵੇਂ ਕਿ ਸਾਨੂੰ ਜਿਸ ਚੀਜ਼ ਥੋੜ੍ਹੀ ਜਾਣਕਾਰੀ ਹੋਣੀ ਚਾਹੀਦੀ ਹੈ ਉਸ ਬਾਰੇ ਜਿਸ ਤਰ੍ਹਾਂ ਬੱਚੇ ਦੇ ਪੈਰ 'ਤੇ ਚੋਟ ਲੱਗ ਜਾਂਦੀ ਹੈ ਤਾਂ ਸਾਨੂੰ ਉਸਦੇ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ ਉਸ ਨੂੰ ਆਰਾਮ ਨਾਲ ਬਿਠਾ ਦੇਣਾ ਚਾਹੀਦਾ ਹੈ ਜ਼ਖਮ ਨੂੰ ਸਾਫ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਜ ਜੇ ਕਿਸੇ ਆਦਮੀ ਨੂੰ ਸੱਪ ਕੱਟ ਲੈਂਦਾ ਹੈ ਤਾਂ ਸਾਨੂੰ ਉਸਦੇ ਥੋੜ੍ਹੇ ਜਿਹੇ ਉੱਪਰ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ ਤਾਂ ਕਿ ਜ਼ਹਿਰ ਉਸਦੇ ਸਾਰੇ ਸਰੀਰ ਵਿੱਚ ਨਾ ਪਹੁੰਚ ਸਕੇ ਅਤੇ ਉਸ ਤੋਂ ਬਾਅਦ ਹੀ ਸਾਨੂੰ ਉਸਨੂੰ ਹਸਪਤਾਲ ਲਿਜਾਣਾ ਚਾਹੀਦਾ ਹੈ ਇਸ ਤਰ੍ਹਾਂ ਸਾਨੂੰ ਸਭ ਤੋਂ ਪਹਿਲਾਂ ਕਿਸੇ ਵੀ ਚੋਟ ਲੱਗਣ 'ਤੇ ਘਰੇਲੂ ਇਲਾਜ ਦੇਣਾ ਬਹੁਤ ਜ਼ਰੂਰੀ ਹੁੰਦਾ ਹੁੰਦਾ ਹੈ ਇਸੇ ਤਰ੍ਹਾਂ ਕਿਸੇ ਦੀ ਹਾਰਟਬੀਟ ਅਚਾਨਕ ਰੁਕ ਜਾਣ ਜਾਂ ਪਾਣੀ ਬੱਚੇ ਦੇ ਮੂੰਹ ਵਿੱਚ ਚਲਾ ਜਾਂਦਾ ਹੈ ਅਤੇ ਉਸਨੂੰ ਕ ਕੱਢਣ ਲਈ ਵੀ ਸਾਨੂੰ ਉਸਦੇ ਬੈਕ ਨੂੰ ਦਬਾ ਕੇ ਦਬਾ ਕੇ ਉਸਦੇ ਪਾਣੀ ਨੂੰ ਨਿਕਾਲਣਾ ਚਾਹੀਦਾ ਹੈ ਜਾਂ ਕਿਸੇ ਦੇ ਹਾਰਟ ਰੁੱਕ ਜਾਣ 'ਤੇ ਉਸਦੇ ਹਾਰਟ 'ਤੇ ਦਬਾਵ ਦੇਣਾ ਚਾਹੀਦਾ ਹੈ ਜਾਂ ਕਿਸੇ ਦੇ ਸਾਹ ਰੁੱਕ ਜਾਣ 'ਤੇ ਸਾਨੂੰ ਫੇਸ ਟੂ ਫੇਸ ਸਾਹ ਦੇਣਾ ਪੈਂਦਾ ਹੈ ਉਸਨੂੰ ਮੂੰਹ 'ਚੋਂ ਸਾਹ ਦੇ ਕੇ ਉਸ ਬੰਦੇ ਨੂੰ ਬਚਾਇਆ ਜਾ ਸਕਦਾ ਹੈ ਉਸਦੀ ਉਸਦੀ ਛਾਤੀ ਨੂੰ ਦਬਾ ਕੇ ਜਾਂ ਮੂੰਹ ਤੋਂ ਸਾਹ ਦੇ ਕੇ ਉਸਨੂੰ ਬ ਉਸਦੀ ਜਾਨ ਬਚਾਈ ਜਾ ਸਕਦੀ ਹੈ ਤੋ ਉਸ ਤੋਂ ਤੁਰੰਤ ਬਾਅਦ ਸਾਨੂੰ ਹੋਸਪੀਟਲ ਲਿਜਾਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਸਾਡੇ ਘਰੇਲੂ ਇਲਾਜ ਨਾ ਕਰਨ ਨਾਲ ਬੱਚੇ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਇਸ ਲਈ ਸਾਨੂੰ ਪਹਿਲਾਂ ਆਪਣਾ ਘਰੇਲੂ ਇਲਾਜ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਹੈ